ਮੈਂ ਆਪਣੇ ਸਕੂਲ ਟੀਚਰਸ ਦੇ ਨਾਲ ਅੰਮ੍ਰਿਤਸਰ ਸਾਹਿਬ ਗਈ ਸੀ ਹਰਿਮੰਦਰ ਸਾਹਿਬ ਜਿੱਥੇ ਜਾ ਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਉੱਥੇ ਅਸੀਂ ਵੱਖ ਵੱਖ ਚੀਜ਼ਾਂ ਵੇਖੀਆਂ ਅਸੀਂ ਵਾਹਗਾ ਵਾਡਰ ਗਏ ਸਭ ਤੋਂ ਪਹਿਲਾਂ ਅਸੀਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਲੰਗਰ ਛਕਿਆ ਉਸ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਅਸੀਂ ਵਾਹਗਾ ਬਾਰਡਰ ਦੇਖਿਆ ਜਿੱਥੇ ਜਾ ਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਫਿਰ ਉਸ ਤੋਂ ਬਾਅਦ ਅਸੀਂ ਜਲਿਆਂਵਾਲਾ ਬਾਗ ਗਏ ਜਿੱਥੇ ਸਾਨੂੰ ਇੱਕ ਸ਼ੋਅ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮਤਲਬ ਹਮਲਾ ਕੀਤਾ ਗਿਆ ਸੀ ਔਰ ਕਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਨੇ ਇਸ ਦਾ ਬਦਲਾ ਲਿਆ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਦੇ ਨਾਲ ਸਾਡੀ ਬਹੁਤ ਜ਼ਿਆਦਾ ਨੌਲੇਜ ਵਧੀ ਹਾਂ ਅਤੇ ਸ਼ਾਮ ਨੂੰ ਉਸ ਤੋਂ ਬਾਅਦ ਅਸੀਂ ਬਜ਼ਾਰ ਘੁੰਮੇ ਆਪਣੇ ਦੋਸਤਾਂ ਦੇ ਨਾਲ ਜਿੱਥੇ ਸਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਅਸੀਂ ਬਹੁਤ ਕੁਝ ਨਵਾਂ ਨਵਾਂ ਦੇਖਿਆ ਉੱਥੋਂ ਅਸੀਂ ਕੁਝ ਚੀਜ਼ਾਂ ਵੀ ਖਰੀਦੀਆਂ ਜੋ ਹੁਣ ਤੱਕ ਸਾਡੇ ਨਾਲ ਯਾਦ ਬਣ ਕੇ ਨੇ ਉਸ ਯਾਤਰਾ ਦੀ